ਹਾਂਜੀ ਜਿਹੜਾ ਪੰਜਾਬੀ ਭਾਸ਼ਾ ਦੇ ਬਾਰੇ ਨਾ ਬਹੁਤ ਸਾਰੀਆਂ ਗਲਤ ਧਾਰਨਾਵਾਂ ਆ ਗਈਆਂ ਪ੍ਰਚਲਿਤ ਹੈਗੀਆਂ ਆਪਣੇ ਸਮਾਜ ਦੇ ਵਿੱਚ ਕਿਉਂਕਿ ਪਹਿਲੀ ਤਾਂ ਇਹੀ ਆ ਵੀ ਜਿਹੜੇ ਪੰਜਾਬੀ ਭਾਸ਼ਾ ਨਾ ਪੇਂਡੂ ਭਾਸ਼ਾ ਕਿਹਾ ਜਾਂਦਾ ਜਿਹੜੇ ਕਈ ਲੋਕ ਨੇ ਇਹੀ ਸੋਚਦੇ ਆ ਜਿਹੜੀ ਪੰਜਾਬੀ ਭਾਸ਼ਾ ਨਾ ਸਿਰਫ ਪੇਂਡੂ ਇਲਾਕਿਆਂ ਵਿੱਚ ਹੀ ਬੋਲੀ ਜਾਂਦੀ ਹੈ ਵੀ ਸ਼ਹਿਰੀ ਜੀਵਨ ਦੇ ਲਈ ਢੁਕਵੀਂ ਭਾਸ਼ਾ ਨਹੀਂ ਗੀ ਅਤੇ ਦੂਜਾ ਕੀ ਹੈਗਾ ਜੀ ਪੰਜਾਬੀ ਭਾਸ਼ਾ ਗੀ ਆਧੁਨਿਕ ਨਹੀਂ ਹੈ ਇਹ ਧਾਰਨਾ ਵੀ ਮੰਨੀ ਜਾਂਦੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਨਾ ਜਿਹੜੀ ਆਧੁਨਿਕ ਵਿਸ਼ਿਆਂ ਦੇ ਬਾਰੇ ਗੱਲ ਕਰਨ ਦੇ ਲਈ ਸ਼ਬਦਾਵਲੀ ਦੀ ਘਾਟ ਹੁੰਦੀ ਹੈ ਅਤੇ ਪੰਜਾਬੀ ਭਾਸ਼ਾ ਕਹਿੰਦੇ ਸਿਰਫ ਸਿੱਖਾਂ ਦੀ ਭਾਸ਼ਾ ਹੈਗੀ ਇਹ ਵੀ ਗਲਤ ਧਾਰਨਾ ਹੈਗੀ ਸਾਡੇ ਇੱਧਰ ਅਤੇ ਇਹ ਧਾਰਨਾ ਬਹੁਤ ਗਲਤ ਹੈ ਜਿਹੜੀ ਪੰਜਾਬੀ ਦੀ ਭਾਸ਼ਾ ਦੀ ਵਿਭਿੰਨਤਾ ਨੂੰ ਨਜ਼ਰ ਅੰਦਾਜ਼ ਕਰਦੀ ਹੈਗੀ ਪੰਜਾਬੀ ਭਾਸ਼ਾ ਹੈਗੀ ਜਿਹੜੀ ਸਿੱਖਾਂ ਤੋਂ ਇਲਾਵਾ ਹਿੰਦੂ ਮੁਸਲਮਾਨ ਅਤੇ ਹੋਰ ਧਰਮਾਂ ਦੇ ਲੋਕ ਵੀ ਬੋਲਦੇ ਨੇ ਪੰਜਾਬੀ ਭਾਸ਼ਾ ਨੂੰ ਕਈ ਲੋਕ ਹਿੰਦੀ ਦਾ ਇੱਕ ਰੂਪ ਵੀ ਮੰਨਦੇ ਨੇ ਕਿਉਂ ਮੰਨਦੇ ਨੇ ਇਹੀ ਤਾਂ ਗੱਲ ਸਭ ਨੂੰ ਨਹੀਂ ਪਤਾ ਲੱਗਦਾ ਕਿਉਂ ਮੰਨਦੇ ਨੇ ਕਿਉਂਕਿ ਉਹ ਕਹਿੰਦੇ ਵੀ ਇੱਕੋ ਜਿਹੀ ਭਾਸ਼ਾ ਹੈਗੀ ਕਹਿੰਦੇ ਇਹਦੇ ਬਹੁਤੇ ਸ਼ਬਦ ਨਾ ਮਿਲਦੇ ਜੁਲਦੇ ਆ ਆਪਸ ਦ ਦੇ ਵਿੱਚ ਅਤੇ ਪੰਜਾਬੀ ਅਤੇ ਹਿੰਦੀ ਕਹਿੰਦੇ ਜਦੋਂ ਕਹਿੰਦੇ ਦੋ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨੇ ਪਰ ਫਿਰ ਵੀ ਇਹਨਾਂ ਦੇ ਸ਼ਬਦ ਮਿਲਦੇ ਨੇ ਜਿਹਨਾਂ ਦੇ ਇਹਨਾਂ ਦੇ ਆਪਣੇ ਵੱਖਰੇ ਇਤਿਹਾਸ ਦੇ ਵਿਸ਼ੇਸ਼ਤਾਵਾਂ ਹਨ ਅਤੇ ਇਹਨਾਂ ਜਿਹੜੀਆਂ ਧਾਰਨਾਵਾਂ ਜਿਹੜੀਆਂ ਗਲਤ ਨੇ ਪੰਜਾਬੀ ਭਾਸ਼ਾ ਦੀਆਂ ਇਹਨਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ ਉਹ ਕਿਵੇਂ ਕਰ ਸਕਦੇ ਸਿੱਖਿਆ ਦੇ ਅਨੁਸਾਰ ਜੇ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਜ਼ਿਆਦਾ ਮਹੱਤਵ ਦਿੱਤਾ ਜਾਣਾ ਚਾਹੀਦਾ ਹੈਗਾ ਕਿਉਂਕਿ ਕਈ ਸਕੂਲਾਂ ਦੇ ਵਿੱਚ ਜਿਹੜਾ ਕਿ ਪੰਜਾਬੀ ਨੂੰ ਇਗਨੋਰ ਕੀਤਾ ਜਾਂਦਾ ਸੀਗਾ ਪਰ ਨਹੀਂ ਹੁਣ ਅੱਜ ਕੱਲ੍ਹ ਜਿਹੜਾ ਕੀ ਆ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਕੂਲਾਂ ਕਾਲਜਾਂ ਵਿੱਚ ਵਧਾਇਆ ਜਾਣ ਲੱਗਿਆ ਪੰਜਾਬੀ ਸਾਹਿਤ ਕਲਾ ਅਤੇ ਸੱਭਿਆਚਾਰ ਨੂੰ ਵੀ ਪ੍ਰਮੋਟ ਕਰ ਰਹੇ ਨੇ ਮੀਡੀਆ ਪੰਜਾਬੀ ਭਾਸ਼ਾ ਦੇ ਵਿੱਚ ਹੋਰ ਮੀਡੀਆ ਚੈਨਲ ਅਖਬਾਰ ਮੈਗਜੀਨ ਆ ਜਿਹੜੀਆਂ ਸ਼ੁਰੂ ਕੀਤੇ ਜਾਣਾ ਚਾਹੀਦੇ ਆ ਤਾਂ ਕਿ ਜਿਹੜੀ ਪੰਜਾਬੀ ਦੀ ਜਿਹੜੀ ਮਹੱਤਤਾ ਗੀ ਬਹੁਤ ਜ਼ਿਆਦਾ ਹੋਰ ਪ੍ਰਫੁਲਿਤ ਹੋਵੇ ਹੈ ਨਾ ਸਰਕਾਰੀ ਸਹਿਯੋਗ ਦੀ ਵੀ ਜ਼ਰੂਰਤ ਹੈਗੀ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਵਧੇਰੇ ਫੰਡ ਮੁਹੱਈਆ ਕਰਾਉਣੇ ਚਾਹੀਦੇ ਨੇ ਸਰਕਾਰੀ ਦਫਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈਗਾ ਅਤੇ ਨਾਲ ਨਾਲ ਸਮਾਜਿਕ ਜਾਗਰੁਕਤਾ ਵੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਸਮਾਜਿਕ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਜਿਹੜਾ ਪੰਜਾਬੀ ਭਾਸ਼ਾ ਨੂੰ ਗਰਵ ਮਹਿਸੂਸ ਕਰਨਾ ਸਿੱਖਿਆ ਜਾਣਾ ਚਾਹੀਦਾ ਹੈਗਾ ਪੰਜਾਬੀ ਭਾਸ਼ਾ ਸਾਡੀ ਸੱਭਿਆਚਾਰ ਅਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹੈਗਾ ਇਸ ਨੂੰ ਬਚਾਉਣ ਅਤੇ ਪ੍ਰਫੁੱਲਿਤ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਪੰਜਾਬੀ ਨੂੰ ਜਿਹੜਾ ਕੀ ਆ ਪ੍ਰਫੁੱਲਿਤ ਕਰਨ ਦੇ ਲਈ ਹੰਭਲਾ ਮਾਰਨਾ ਚਾਹੀਦਾ ਹੈ